ਇੰਟਰਨੈੱਟ ਦੇ ਬੈਂਕਿੰਗ ਦੇ ਵਿੱਚ ਗੱਲ ਕਰੀਏ ਤਾਂ ਪਹਿਲਾਂ ਪੁਰਾਣੇ ਸਮੇਂ ਵਿੱਚ ਜਿਹੜਾ ਬਿੰਕ ਬੈਂਕਿੰਗ ਦਾ ਜਿਹੜਾ ਪ੍ਰੋਸੈਸ ਸੀ ਜਿਵੇਂ ਅੱਜ ਤੋਂ ਵੀਹ ਸਾਲ ਪਹਿਲਾਂ ਦਾ ਤਾਂ ਉਹ ਬਹੁਤ ਹੌਲੀ ਸੀ ਜਿਵੇਂ ਲੋਕ ਆਪਣਾ ਕੰਮ ਕਾਰ ਛੱਡ ਕੇ ਲਾਈਨ ਦੇ ਵਿੱਚ ਲੱਗਦੇ ਸੀ ਪੈਸੇ ਕਢਵਾਉਣ ਲੈਣ ਦੇਣ ਕਰਨ ਦੇ ਵਿੱਚ ਫਿਰ ਉਹ ਬਾਊਚਰ ਭਰਦੇ ਸੀ ਫਿਰ ਲਾਈਨ 'ਚ ਲੱਗਦੇ ਸੀ ਮਤਲਬ ਕਿ ਸਾਰਾ ਸਿਸਟਮ ਨਾ ਬਹੁਤ ਹੀ ਹੌਲੀ ਸੀਗਾ ਪਰ ਜੇ ਅੱਜ ਦੇ ਓਨਲਾਈਨ ਬੈਂਕਿੰਗ ਦੀ ਗੱਲ ਕਰੀਏ ਤਾਂ ਇਹਦਾ ਜਿਹੜਾ ਪ੍ਰੋਸੈਸ ਹੈ ਬਹੁਤ ਤੇਜ਼ ਹੋ ਚੁੱਕਿਆ ਹੈ ਸਾਨੂੰ ਪਹਿਲੀ ਗੱਲ ਲਾਈਨ 'ਚ ਲੱਗਣ ਦੀ ਲੋੜ ਨਹੀਂ ਜਿਵੇਂ ਗੂਗਲ ਪੇ ਅਸੀਂ ਗੂਗਲ ਪੇ ਯੂਜ਼ ਕਰਦੇ ਹੈ ਨਾ ਤਾਂ ਸਾਨੂੰ ਗੂਗਲ ਪੇ ਵਿੱਚ ਅਸੀਂ ਜਿਵੇਂ ਲਿਮਿਟ ਬੈਂਕਿੰਗ ਦੀ ਰੱਖੀ ਹੋਈ ਹੈ ਵੀਹ ਹਜ਼ਾਰ ਤੋਂ ਪੰਜਾਹ ਹਜ਼ਾਰ ਤੱਕ ਅਸੀਂ ਪੇ ਕਰ ਸਕਦੇ ਹਾਂ ਤਾਂ ਉਹਦੇ ਵਿੱਚ ਸਾਨੂੰ ਉਹ ਕੁਛ ਲਿਮਟਾਂ ਬੈਂਕਿੰਗ ਨੇ ਰੱਖੀਆਂ ਹੋਈਆਂ ਵੀ ਅਸੀਂ ਵੀ ਸਾਨੂੰ ਐਮਰਜੈਂਸੀ ਅਗਰ ਬੈਂਕ ਦੇ ਵਿੱਚ ਛੁੱਟੀ ਹੁੰਦੀ ਹੈ ਨਾ ਤਾਂ ਸਾਨੂੰ ਐਮਰਜੈਂਸੀ ਲੋੜ ਹੈਗੀ ਹੈ ਤਾਂ ਅਸੀਂ ਆਪਦਾ ਗੁਜ਼ਾਰਾ ਕਰ ਸਕਦੇ ਹੈਗੇ ਵੀ ਸਾਨੂੰ ਇੰਟਰਨੈੱਟ ਨੇ ਬਹੁਤ ਹੀ ਸੁਵਿਧਾ ਕੀਤੀ ਹੈ ਜਿਹੜੀ ਓਨਲਾਈਨ ਬੈਂਕਿੰਗ ਦਾ ਸਿਸਟਮ ਹੈ ਜਿਹੜਾ ਉਹ ਬਹੁਤ ਹੀ ਭਰੋਸੇਯੋਗ ਹੋ ਗਿਆ ਅਤੇ ਬਹੁਤ ਤੇਜ਼ ਹੋ ਗਿਆ ਇਸ ਨਾਲ ਕਿਸਾਨਾਂ ਦੀ ਵੀ ਅਤੇ ਦੂਸਰੇ ਸਾਰੇ ਵਰਕਰਾਂ ਦੀ ਜ਼ਿੰਦਗੀ ਹੈ ਜਿਹੜੀ ਅਸਾਨ ਹੋ ਗਈ ਹੈ ਰੇਹੜੀ ਵਾਲੇ ਤੋਂ ਲੈ ਕੇ ਰੇਹੜੀ ਵਾਲੇ ਦੀ ਵੀ ਗੱਲ ਕਰੀਏ ਅਗਰ ਕੋਈ ਸਬਜ਼ੀ ਲੈਣ ਜਾਣੀ ਹੈ ਤਾਂ ਅਗਰ ਕੈਸ਼ ਨਹੀਂ ਹੈ ਤਾਂ ਉਹ ਸਾਰਾ ਓਨਲਾਈਨ ਗੂਗਲ ਪੇ ਯੂ ਪੀ ਆਈ ਅਸੀਂ ਕਰ ਸਕਦੇ ਹਾਂ ਜਿੰਨਾ ਵੀ ਸਿਸ ਵੀ ਸਾਨੂੰ ਅੱਜ ਦੇ ਵੀ ਟਾਈਮ ਸਾਨੂੰ ਤੰਗ ਨਹੀਂ ਹੋਣਾ ਪੈਣਾ ਪਰ ਕਦੇ ਕਦੇ ਅਗਰ ਇਸਦਾ ਪ੍ਰੋਸੈਸ ਸਲੋ ਹੋ ਜਾਂਦਾ ਹੈ ਤਾਂ ਸਾਨੂੰ ਕਦੇ ਕਦੇ ਹੀ ਬੈਂਕ ਜਾਂਦੇ ਹਾਂ ਪਰ ਐਮਰਜੰਸੀ ਦੇ ਵਿੱਚ ਵੀ ਸਾਡਾ ਸ਼ਲਿਊਸ਼ਨ ਹੋ ਜਾਂਦਾ ਹੈ ਇਸ ਲਈ ਜਿਹੜੇ ਇੰਟਰਨੈੱਟ ਦੀ ਬੈਂਕਿੰਗ ਸੁਵਿਧਾ ਹੈ ਉਹ ਬਹੁਤ ਵਧੀਆ ਹੈ ਬਹੁਤ ਸਫਲ ਹੈ ਇਸ ਨਾਲ ਸਾ ਸਭ ਕਿਸਾਨਾਂ ਦੀ ਖਾਸ ਕਰਕੇ ਉਹਨਾਂ ਦੀ ਜ਼ਿੰਦਗੀ ਅਸਾਨ ਹੋ ਗਈ ਹੈ ਧੰਨਵਾਦ